ਮੈਂ ਪੰਜਾਬ ਰਾਜ ਦੀ ਰਹਿਣ ਵਾਲੀ ਹਾਂ ਮੈਂ ਪੰਜਾਬ ਰਾਜ ਵਿੱਚ ਹੋ ਰਹੀ ਗੁੰਡਾਗਰਦੀ ਨਸ਼ਿਆਂ ਖਿਲਾਫ ਮੌਤਾਂ ਧੋਖਾਧੜੀ ਲ ਲੁੱਟ ਖਸੁੱਟ ਆਦਿ ਬਾਰੇ ਲਿਖਣਾ ਪਸੰਦ ਕਰਾਂਗੀ ਮੈਂ ਇਹਨਾਂ ਗੱਲਾਂ ਨੂੰ ਸਮਾਜ ਤੱਕ ਪਹੁੰਚਾਉਣਾ ਚਾਹਾਂਗੀ ਮੈਂ ਆਪਣੀਆਂ ਗੱਲਾਂ ਨੂੰ ਸਮਾਜ ਨੂੰ ਦੱਸਣਾ ਚਾਹਾਂਗੀ ਮੈਂ ਸਮਾਜ ਨੂੰ ਸੰਦੇਸ਼ ਦੇਣਾ ਚਾਹੁੰਦੀ ਹਾਂ ਕਿ ਉਹ ਆਪਣੇ ਪੰਜਾਬੀ ਸੱਭਿਆਚਾਰ ਨੂੰ ਖਤਮ ਨਾ ਹੋਣ ਦੇਣ ਆਪਣੇ ਪੰਜਾਬੀ ਵਿਰਸੇ ਨੂੰ ਸਾਂਭ ਕੇ ਰੱਖਣ ਪੰਜਾਬ ਰਾਜ ਭਾਰਤ ਦੇ ਸਾਰੇ ਰਾਜਾਂ ਨਾਲੋਂ ਖੁਸ਼ਹਾਲ ਰਾਜ ਹੈ ਜਿਸ ਨੂੰ ਦੀ ਵਿਰਾਸਤ ਨੂੰ ਸੰਭਾਲਣਾ ਬਹੁਤ ਜ਼ਰੂਰੀ ਹੋ ਗਿਆ ਹੈ ਪਰ ਅੱਜ ਦੇ ਨੌਜਵਾਨ ਆਪਣੀ ਪੰਜਾਬੀ ਵਿਰਾਸਤ ਨੂੰ ਭੁੱਲ ਚੁੱਕੇ ਹਨ